ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਮਾਨ ਸਿੰਘ ਮੈਂ ਪਿਛਲੇ ਹਫ਼ਤੇ ਤੁਹਾਡੇ ਹੈੱਡਫੋਨ ਖਰੀਦੇ ਸੀ ਜੋ ਕਿ ਜਮ੍ਹਾਂ ਤੇ ਹੀ ਵਧੀਆ ਨਹੀਂ ਹਨ ਪਹਿਲਾਂ ਉਹਨਾਂ ਦੀ ਪੈਕਿੰਗ ਹੀ ਬਹੁਤ ਹੀ ਬੇਕਾਰ ਸੀ ਜੋ ਕਿ ਮੈਨੂੰ ਜਮ੍ਹਾਂ ਤੇ ਪਸੰਦ ਨਹੀਂ ਲੱਗੀ ਅਤੇ ਇਸਦੇ ਵਿੱਚ ਜੋ ਤੁਸੀਂ ਹੈੱਡਫੋਨ ਦਿੱਤੇ ਸੀ ਮੈਂ ਸਲੈਕਟ ਕਰੇ ਤੇ ਉਹ ਹੈੱਡਫੋਨ ਇਸ ਤੋਂ ਇਲਾਵਾ ਦੂਏ ਹੈੱਡਫੋਨ ਹੀ ਨਿਕਲੇ ਹਨ ਅਤੇ ਜਦੋਂ ਮੈਂ ਉਹ ਹੈੱਡਫੋਨ ਚਲਾ ਕੇ ਵੇਖੇ ਪਹਿਲਾਂ ਤਾਂ ਉਹ ਫੋਨ ਨਾਲ਼ ਕਨੈਕਟ ਹੀ ਬਹੁਤ ਔਖੇ ਹੋਏ ਹਨ ਜਦ ਜੇਕਰ ਉਹ ਕਨੈਕਟ ਹੋਏ ਤਾਂ ਉਹਨਾਂ ਦੀ ਸਾਊਂਡ ਜਿਹੜੀ ਉਹ ਜਮ੍ਹਾਂ ਕੋਐਲਟੀ ਉਹ ਜਮ੍ਹਾਂ ਤੇ ਬੇਕਾਰ ਸੀ ਜੋ ਕਿ ਮੈਨੂੰ ਮੈਂ ਜਮ੍ਹਾਂ ਤੇ ਪਸੰਦ ਨਹੀਂ ਲੱਗੀ ਅਤੇ ਮੈਂ ਹਜ਼ਾਰ ਰੁਪਇਆ ਵੀ ਲਾਇਆ ਸੀ ਪਰ ਇਹਨਾਂ ਦੀ ਮੇਰੀ ਪੈਸਿਆਂ ਦਾ ਮੁੱਲ ਨਹੀਂ ਪਿਆ ਅਤੇ ਮੇਰੇ ਘਰ ਦੇ ਵੀ ਮੈਨੂੰ ਖਿੱਝਦੇ ਸੀ ਕਿ ਕੀ ਇਹ ਤੈਂਅ ਕੀ ਔਨਲਾਇਨ 'ਤੇ ਮੰਗਾ ਲਿਆ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਤੁਹਾਡਾ ਇਹ ਪ੍ਰੋਡਕਟ ਹੈ ਇਹ ਜਮ੍ਹਾਂ ਤੇ ਹੀ ਬੇਕਾਰ ਹੈ ਨਾ ਤਾਂ ਇਹਦੀ ਬੈਟਰੀ ਹੈਲਥ ਹੈ ਉਹ ਵੀ ਤੁਸੀਂ ਤਿੰਨ ਘੰਟੇ ਕਿਹਾ ਸੀ ਉਹ ਵੀ ਇੱਕ ਘੰਟਾ ਵੀ ਨਹੀਂ ਕੱਢਦੀ ਅਤੇ ਇਹਦੇ ਜਿਹੜੇ ਔ ਟੱਚ ਉਹ ਵੀ ਨਹੀਂ ਚੱਲਦੀ ਅਤੇ ਇਹਦੀਆਂ ਤਾਰਾਂ ਤ ਤਾਰ ਜਿਹੜੀ ਹੈ ਉਹ ਵੀ ਆ ਵਿੱਚ ਵਿੱਚ ਤੋਂ ਕਰੈੱਕ ਸੀ ਧੰਨਵਾਦ